ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਅਪੂਰਵਾ ਬੋਲ ਰਹੀ ਹੈ ਮੈਮ ਮੈਂ ਤਾਡੇ ਕੋਲੋਂ ਮੈਮ ਸਲਾਹ ਲੈਣੀ ਸੀ ਮੈਮ ਮੈਂ ਪਲੱਸ ਟੂ ਕਲਾਸ ਕਲੀਅਰ ਕੀਤੀ ਹੈਗੀ ਹੈ ਸਾਇੰਸ ਸਟਰੀਮ ਤੋਂ ਅਤੇ ਹੁਣ ਮੈਂ ਜਾਣਨਾ ਚਾਹੁੰਦੀ ਹੈ ਕਿ ਮੈਂ ਅੱਗੇ ਕਿਹੜੀ ਡਿਗਰੀ ਕਰਾਂ ਅਤੇ ਕਿਸ ਕੋਲਜ ਤੋਂ ਮੈਨੂੰ ਵਧੀਆ ਰਹੇਗਾ ਮੈਮ ਮੈਂ ਨੋਨ ਮੈਡੀਕਲ ਤੋਂ ਕੀਤੀ ਹੈ ਹੈਲੋ ਮੈਮ ਮੈਂ ਕਮਿਸਟਰੀ ਦੇ ਵਿੱਚ ਜ਼ਿਆਦਾ ਇੰਟਰਸਟ ਰੱਖਦੀ ਹਾਂ ਔਰ ਮੈਂ ਮੈਂ ਨਾ ਸੋਚਿਆ ਥਾ ਕਿ ਮੈਂ ਬੀ ਫਾਰਮੈਸੀ ਕਰਾਂ ਬਟ ਅੱਗੇ ਸਮਝ ਨਹੀਂ ਆ ਰਿਹਾ ਕਿ ਉਹ ਬੀ ਫਾਰਮੈਸੀ ਮੈਂ ਕਿਸ ਯੂਨੀਵਰਸਿਟੀ ਤੋਂ ਕਰਾਂ ਅਗਰ ਮੈਂ ਪੰਜਾਬ ਯੂਨੀਵਰਸਿਟੀ ਤੋਂ ਕਰਦੀ ਹੈ ਤਾਂ ਉਨ੍ਹਾਂ ਦੇ ਅੰਡਰ ਸਕੋਲਰਸ਼ਿਪ ਦਾ ਕਿਆ ਹੈ ਜਨਰਲ ਕਾਸਟ ਦੇ ਲਈ ਠੀਕ ਹੈ ਮੈਮ ਜੀ ਧੰਨਵਾਦ